ਸਾਡੇ ਜ਼ਿਲ੍ਹੇ ਦੇ ਵਿੱਚ ਜ਼ਿਆਦਾਤਰ ਤਾਂ ਪ੍ਰਾਈਵੇਟ ਕੋਲਜ ਹਨ ਪਰ ਇੱਕ ਜਿਹੜਾ ਸਰਕਾਰੀ ਕੋਲਜ ਹੈ ਅਤੇ ਉਸ ਵਿੱਚ ਸਾਨੂੰ ਸਸਤੀ ਸਿੱਖਿਆ ਪੈ ਜਾਂਦੀ ਹੈ ਅਤੇ ਜਿਹੜੇ ਬਾਕੀ ਪ੍ਰਾਈਵੇਟ ਕੋਲਜ ਨੇ ਉਹਨਾਂ ਵਿੱਚ ਸਾਨੂੰ ਬਹੁਤ ਜ਼ਿਆਦਾ ਮਹਿੰਗੀ ਸਿੱਖਿਆ ਪੈਂਦੀ ਹੈ ਅਤੇ ਉਸ ਤੋਂ ਬਾਅਦ ਅਗਰ ਅਸੀਂ ਆਈ ਆਈ ਟੀ ਦੀ ਗੱਲ ਕਰੀਏ ਤਾਂ ਉਹ ਸਾਡੇ ਜ਼ਿਲ੍ਹੇ ਤੋਂ ਬਾਹਰ ਪੈਂਦੀ ਹੈ ਉਹ ਸਾਨੂੰ ਦੂਜੇ ਜ਼ਿਲ੍ਹੇ ਦੇ ਵਿੱਚ ਜਾਣਾ ਪੈਂਦਾ ਹੈ ਉਸ ਲਈ